ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਬਹੁਤ ਹੀ ਜ਼ਿਆਦਾ ਆਪਣੇ ਭਾਰਤ ਦੇ ਵਿੱਚ ਸਕੀਮਾਂ ਹਨ ਜਿਵੇਂ ਆਪਾਂ ਅੱਜ ਗੱਲ ਕਰਾਂਗੇ ਇੱਕ ਸਕੀਮ ਬਾਰੇ ਜਿਵੇਂ ਕਿ ਆਯੁਸ਼ਮਾਨ ਕਾਰਡ ਆਯੁਸ਼ਮਾਨ ਕਾਰਡ ਦੇ ਵਿੱਚ ਉਹ ਮੇਰਾ ਖੁਦ ਦਾ ਕਾਰਡ ਬਣਿਆ ਹੈ ਮੇਰੀ ਫੈਮਿਲੀ ਦਾ ਕਾਰਡ ਬਣਿਆ ਹੋਇਆ ਹੈ ਮੇਰੇ ਫਾਦਰ ਸਾਹਿਬ ਨੂੰ ਅੱਖਾਂ ਦੀ ਪ੍ਰੋਬਲਮ ਸੀ ਮੋਤੀਏ ਦੀ ਅਤੇ ਉਹਨਾਂ ਨੇ ਉਹਨਾਂ ਦਾ ਉਹ ਆਯੁਸ਼ਮਾਨ ਕਾਰਡ ਦੇ ਵਿੱਚ ਜੋ ਕਿ ਭਾਰਤ ਸਰਕਾਰ ਵੱਲੋਂ ਬਣਿਆ ਹੋਇਆ ਹੈ ਅਤੇ ਉਸ ਕਾਰਡ ਦੇ ਵਿੱਚ ਉਹਨਾਂ ਦਾ ਓਪਰੇਸ਼ਨ ਹੋਇਆ ਹੈ ਅੱਖਾਂ ਦਾ ਜਿਸ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਹੈ ਅਤੇ ਆਪਾਂ ਅੱਗੇ ਉਹ ਕਾਰਡ ਬਾਰੇ ਅੱਗੇ ਤੋਂ ਅੱਗੇ ਵੀ ਦ ਦੱਸਦੇ ਹਾਂ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਲੋਕਾਂ ਦੀ ਹੈਲਪ ਵੀ ਕਰ ਕਰਵਾਉਂਦੇ ਹਾਂ ਉਹਨਾਂ ਨੂੰ ਕਾਰਡ ਬਣਾਉਣ ਦੀ ਸਲਾਹ ਵੀ ਦਿੰਦੇ ਹਾਂ